ਮੈਂ ਅਤੇ ਮੇਰਾ ਪਰਿਵਾਰ ਅਸੀਂ ਧਾਰਮਿਕ ਤਿਉਹਾਰ ਆਪਣੇ ਘਰ ਦੇ ਵਿੱਚ ਹੀ ਮਨਾਉਣਾ ਪਸੰਦ ਕਰਦੇ ਹਾਂ ਅਸੀਂ ਇਹਦੇ ਲਈ ਸਾਡਾ ਮੇਨ ਧਿਆਨ ਹੁੰਦਾ ਕਿ ਉਸ ਦਿਨ ਕੀ ਖਾਣਾ ਬਣੇਗਾ ਕੀ ਅਸੀਂ ਨਾਸ਼ਤੇ ਵਿੱਚ ਬਣਾਵਾਂਗੇ ਕੀ ਅਸੀਂ ਦੁਪਹਿਰੇ ਬਣਾਵਾਂਗੇ ਅਤੇ ਕੀ ਅਸੀਂ ਰਾਤ ਨੂੰ ਬਣਾਵਾਂਗੇ ਕਿਉਂਕਿ ਸਾਡੇ ਬੱਚੇ ਜੋ ਹੈ ਇਹ ਖਾਣਾ ਪੀਣਾ ਫੈਂਸੀ ਚੀਜ਼ਾਂ ਕਾਫੀ ਪਸੰਦ ਕਰਦੇ ਹਨ ਅਤੇ ਸਾਡਾ ਇਸ ਲਈ ਮੇਨ ਤਵੱਜੋਂ ਤਾਂ ਇਹੀ ਹੁੰਦੀ ਹੈ ਕਿ ਅਸੀਂ ਸਾਡੇ ਘਰ ਦੇ ਵਿੱਚ ਕੀ ਖਾਣਾ ਬਣੇਗਾ ਦੂਜਾ ਅਸੀਂ ਜਦੋਂ ਵੀ ਜਿਸ ਤਰ੍ਹਾਂ ਕਿ ਦੀਵਾਲੀ ਆਉਂਦੀ ਹੈ ਦੀਵਾਲੀ ਵੇਲੇ ਅਸੀਂ ਘਰ ਦੀ ਸਾਰੀ ਸਫਾਈ ਕਰਦੇ ਹੈ ਸਾਰੇ ਪਰਦੇ ਆਦਿ ਸਾਫ ਕਰਵਾਉਂਦੇ ਹਾਂ ਸਾਰੇ ਜਾਲੇ ਲਾ ਦਿੰਦੇ ਹਾਂ ਸਾਰੇ ਜਾਲੇ ਲਾ ਕੇ ਸਾਰੇ ਘਰ ਦੀ ਅਲਮਾਰੀਆਂ ਦੀ ਚੰਗੀ ਤਰ੍ਹਾਂ ਸਫਾਈ ਕਰਦੇ ਹੈ ਜਿਹੜਾ ਕੋਈ ਪੁਰਾਣਾ ਸਮਾਨ ਪਿਆ ਹੁੰਦਾ ਉਹ ਕੱਢ ਕੇ ਦਾਨ ਦੂਨ ਕਰ ਦਿੰਦੇ ਹਾਂ ਅਤੇ ਨਵੀਆਂ ਚੀਜ਼ਾਂ ਹੋਰ ਵੀ ਨਵੇਂ ਬਰਤਨ ਲਿਆਉਂਦੇ ਹਾਂ ਨਵੇਂ ਕੱਪੜੇ ਲਿਆਉਂਦੇ ਹੈ ਅਤੇ ਜਿਹੜੇ ਪੁਰਾਣੇ ਕੱਪੜੇ ਹੁੰਦੇ ਆ ਉਹ ਅਸੀਂ ਗਰੀਬਾਂ ਨੂੰ ਦਾਨ ਕਰ ਦਿੰਦੇ ਹਾਂ ਅਤੇ ਅਸੀਂ ਘਰ ਦੀ ਡੈਕੋਰੇਸ਼ਨ ਵੀ ਕਰਦੇ ਹਾਂ ਅਸੀਂ ਰੋਸ਼ਨੀਆਂ ਲਗਾਉਂਦੇ ਹਾਂ ਅਸੀਂ ਹੋਰ ਲਾਈਟਾਂ ਜਗਾਉਂਦੇ ਹਾਂ ਅਤੇ ਅਸੀਂ ਫੁੱਲਾਂ ਦੇ ਨਾਲ ਵੀ ਘਰ ਨੂੰ ਸਜਾਉਂਦੇ ਹਾਂ ਫੁੱਲਾਂ ਦੀਆਂ ਲੜੀਆਂ ਅਸੀਂ ਗੇਟ 'ਤੇੇ ਲਗਾਉਂਦੇ ਹਾਂ ਵਧੀਆ ਭੋਜਨ ਬਣਾਉਂਦੇ ਹਾਂ ਅਤੇ ਸੋਹਣੀ ਸਜਾਵਟ ਕਰਦੇ ਹਾਂ